ਕਿਉਂਕਿ ਭੰਗੜਾ ਇੱਕ ਵਧੀਆ ਐਕਸਰਸਾਈਜ਼ ਹੈ ਅਤੇ ਇਸ ਨਾਲ ਸ ਸਾਡੇ ਲੱਤਾਂ ਬਾਹਵਾਂ ਅਤੇ ਪੂਰਾ ਸਰੀਰ ਐਕਸਰਸਾਈਜ਼ ਦੇ ਮੋਡ ਵਿੱਚ ਆ ਜਾਂਦਾ ਹੈ ਅਤੇ ਮੋਸਟਲੀ ਇਹ ਸਾਡੇ ਪੰਜਾਬ ਦਾ ਵਿਰਸਾ ਹੈ ਜਦੋਂ ਕਿਸਾਨ ਦੀ ਸਫ਼ਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਉਹਨੂੰ ਵੇਚਣ ਜਦੋਂ ਜਾਂਦਾ ਹੈ ਤਾਂ ਖੁਸ਼ੀ ਵਿੱਚ ਭੰਗੜਾ ਪਾਉਂਦਾ ਹੈ ਅਤੇ ਜਾਂ ਨਵੇਂ ਬੱਚੇ ਦਾ ਜਨਮ ਜਾਂ ਕੋਈ ਵਿਆਹ ਸ਼ਾਦੀ ਹੁੰਦੀ ਹੈ ਤਾਂ ਉਦੋਂ ਭੰਗੜਾ ਪਾਇਆ ਜਾਂਦਾ ਹੈ ਅਤੇ ਖੁਸ਼ੀ ਦੇ ਇ ਇਜ਼ਹਾਰ ਨੂੰ ਭੰਗੜਾ ਸਾਡੇ ਪੇਸ਼ ਕਰਦਾ ਹੈ ਅਤੇ ਇੱਕ ਇੱਕ ਵਧੀਆ ਐਕਸਰਸਾਈਜ਼ ਹੈ ਅਤੇ ਇਹਦੇ ਨਾਲ ਸਾਡੇ ਜਿਹੜੇ ਰਿਸ਼ਤੇਦਾਰਾਂ ਦਾ ਯਾਰਾਂ ਮਿੱਤਰਾਂ ਦਾ ਆਪਸ ਵਿੱਚ ਬਹੁਤ ਹੀ ਪ੍ਰੇਮ ਵੱਧਦਾ ਹੈ ਭੰਗੜਾ ਸਾਡੇ ਲਈ ਇੱਕ ਵੈਸੇ ਭੰਗੜਾ ਸਾਡੇ ਲਈ ਇੱਕ ਇਸ ਕਰਕੇ ਵੀ ਜ਼ਰੂਰੀ ਹੈ ਇਹ ਸਾਡੀ ਖੁਸ਼ੀ ਨੂੰ ਦੁੱਗਣਾ ਕਰ ਦਿੰਦਾ ਹੈ ਅਤੇ ਜਦੋਂ ਕੋਈ ਵਿਆਹ ਸ਼ਾਦੀ ਜਾਂ ਕੋਈ ਬੱਚੇ ਦਾ ਜਨਮਦਿਨ ਹੁੰਦਾ ਹੈ ਉਦੋਂ ਭੰਗੜਾ ਪਾਇਆ ਜਾਂਦਾ ਹੈ ਅਤੇ ਸਾਡੇ ਵਿਰਸੇ ਦੀ ਪਛਾਣ ਹੈ ਜਦੋਂ ਸਾਡੀਆਂ ਫ਼ਸਲਾਂ ਪੱਕ ਜਾਂਦੀਆਂ ਨੇ ਅਤੇ ਜਾਂ ਕੋਈ ਅਸੀਂ ਨਵਾਂ ਕੰਮ ਸ਼ੁਰੂ ਕਰਦੇ ਹਾਂ ਜਾਂ ਕੋਈ ਵੀ ਅਸੀਂ ਕੰਮ ਸ਼ੁਰੂ ਕਰਦੇ ਹੈ ਤਾਂ ਸਾਡਾ ਵਿਰਸਾ ਹੈ ਕਿ ਭੰਗੜਾ ਪਾਉਣਾ ਭੰਗੜੇ ਦੇ ਨਾਲ ਨਾਲ ਇਹ ਸਾਡੇ ਸਰੀਰ ਨੂੰ ਐਕਟਿਵ ਰੱਖਦਾ ਹੈ ਅਤੇ ਐਕਸਰਸਾਈਜ਼ ਵਜੋਂ ਵੀ ਅਸੀਂ ਕਰਦੇ ਹਾਂ ਇਸ ਕਰਕੇ ਭੰਗੜਾ ਸਾਡਾ ਵਿਰਸਾ ਅਤੇ ਸਰੀਰਿਕ ਐਕਟੀਵਿਟੀ ਲਈ ਹੈ